ਸਭ ਤੋਂ ਪਹਿਲਾਂ ਮੈਂ ਪੰਜਾਬੀ ਡਾਂਸ ਜਿਹਨੂੰ ਕਿ ਆਮ ਕਰਕੇ ਭੰਗੜਾ ਕਿਹਾ ਜਾਂਦਾ ਹੈ ਉਹ ਇੱਕ ਚੰਗੇ ਮਾਹਰ ਕੋਲੋਂ ਸਿੱਖਿਆ ਉਹ ਸਿੱਖਣ ਤੋਂ ਬਾਅਦ ਮੈਨੂੰ ਕਾਲਜ ਦੀ ਟੀਮ ਵਿੱਚ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਜੋ ਕਿ ਮੈਂ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਬਾਕੀ ਦੂਜੇ ਲੋਕਾਂ ਨੇ ਮੇਰੇ ਕੰਮ ਦੀ ਬੜੀ ਸ਼ਲਾਘਾ ਕੀਤੀ ਫਿਰ ਮੈਨੂੰ ਦੂਜੇ ਵਿਦਿਆਰਥੀਆਂ ਨੂੰ ਭੰਗੜਾ ਸਿਖਾਉਣ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਕਾਲਜ ਦੀ ਇੱਕ ਹੋਰ ਭੰਗੜਾ ਟੀਮ ਤਿਆਰ ਕਰਨੀ ਸੀ ਉਹ ਜਿਹੜਾ ਅਨੁਭਵ ਸੀ ਬਹੁਤ ਹੀ ਵਧੀਆ ਸੀ ਕਿਉਂਕਿ ਇਸ ਨਾਲ ਮੈਂ ਅਲੱਗ ਅਲੱਗ ਢੰਗ ਤਰੀਕਿਆਂ ਨਾਲ ਦੂਜੇ ਵਿਦਿਆਰਥੀਆਂ ਨੂੰ ਭੰਗੜਾ ਸਿਖਾਇਆ ਮੈਂ ਮਨ ਹੀ ਮਨ ਬਹੁਤ ਖੁਸ਼ ਹੋ ਰਿਹਾ ਸੀ ਕਿ ਮੇਰਾ ਸਿੱਖਿਆ ਹੋਇਆ ਭੰਗੜਾ ਦੂਜੇ ਵਿਦਿਆਰਥੀਆਂ ਦੇ ਕੰਮ ਆਇਆ